ਮੇਰਾ ਨਾਮ ਦੀਪਕ ਸਮਿਆਲ ਆ ਮੈਂ ਪੰਜਾਬ ਦੇ ਵਿੱਚ ਪਿੰਡ ਹੱਲੇ ਦਾ ਨਿਵਾਸੀ ਹਾਂ ਮੇਰਾ ਜ਼ਿਲ੍ਹਾ ਗੁਰਦਾਸਪੁਰ ਹੈ ਔਰ ਮੇਰੇ ਖਿਆਲ ਮੁਤਾਬਕ ਕਿ ਸਾਡੇ ਰਾਜ ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਵਿੱਚ ਪੰਜਾਬੀ ਭਾਸ਼ਾ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਿਸੇ ਵੀ ਰਾਜ ਦੀ ਜਿਹੜੀ ਰਾਜ ਭਾਸ਼ਾ ਹੁੰਦੀ ਹੈ ਉਸ ਭਾਸ਼ਾ ਦੀ ਜਿਹੜੀ ਦੇਣ ਹੈ ਕੋਈ ਵੀ ਨਹੀਂ ਦੇ ਸਕਦਾ ਕਿਉਂਕਿ ਇਸ ਰਾਜ ਭਾਸ਼ਾ ਪੰਜਾਬੀ ਦੇ ਸਦਕਾ ਹੀ ਅਸੀਂ ਸਿੱਖਿਆ ਪ੍ਰਣਾਲੀ ਵਿੱਚ ਅੱਗੇ ਵੱਧ ਸਕਦੇ ਹਾਂ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਜਿਹੜੇ ਛੋਟੇ ਬੱਚੇ ਹੁੰਦੇ ਆ ਉਹ ਆਪਣੀ ਮਾਤ ਭਾਸ਼ਾ ਵਿੱਚ ਸਿੱਖਣਾ ਜਿਹੜਾ ਵਾ ਉਹ ਜਲਦੀ ਸਿੱਖ ਸਕਦੇ ਆ ਮਾਤ ਭਾਸ਼ਾ ਨੂੰ ਜਿਵੇਂ ਅਸੀਂ ਕਹਿ ਸਕਦੇ ਕਿ ਜਿਹੜੀ ਭਾਸ਼ਾ ਸਾਡੇ ਆਸ ਪਾਸ ਸਾਡੇ ਚੁਗਿਰਦੇ ਵਿੱਚ ਬੋਲੀ ਜਾਂਦੀ ਆ ਜਾਂ ਪੰਜਾਬੀ ਸ਼ਬਦਾਂ ਵਿੱਚ ਜੇ ਅਸੀਂ ਪਰਿਭਾਸ਼ਾ ਦੇਣੀ ਹੋਏ ਤਾਂ ਮਾਤ ਭਾਸ਼ਾ ਉਹ ਭਾਸ਼ਾ ਹੁੰਦੀ ਹੈ ਜਿਹੜੀ ਆਪਾਂ ਅਸੀਂ ਆਪਣੀ ਮਾਂ ਤੋਂ ਸਿੱਖਦੇ ਹਾਂ ਮਾਂ ਦੀ ਗੋਦੀ ਵਿੱਚ ਬਹਿ ਕੇ ਸਿਖਦੇ ਹਾਂ ਸੋ ਮੇਰੇ ਮੁਤਾਬਕ ਜਿਹੜੀ ਰਾਜ ਭਾਸ਼ਾ ਸਿੱਖਿਆ ਪ੍ਰਣਾਲੀ ਵਿੱਚ ਬਹੁਤ ਜ਼ਿਆਦਾ ਭੂਮਿਕਾ ਨਿਭਾਉਂਦੀ ਕਿਉਂਕਿ ਸਕੂਲ ਵਿੱਚ ਜਦੋਂ ਅਸੀਂ ਜਾਂਦੇ ਹਾਂ ਤਾਂ ਸਕੂਲ ਵਿੱਚ ਅਸੀਂ ਆਪਣੇ ਅਧਿਆਪਕਾਂ ਨਾਲ ਆਪਣੇ ਪ੍ਰਿੰਸੀਪਲ ਨਾਲ ਆਪਣੇ ਸਹਿਪਾਠੀਆਂ ਨਾਲ ਜਿਹੜੀ ਅਸੀਂ ਗੱਲਬਾਤ ਕਰਦੇ ਹਾਂ ਉਹ ਅਸੀਂ ਆਪਣੀ ਰਾਜ ਭਾਸ਼ਾ ਵਿੱਚ ਕਰਦੇ ਹਾਂ ਔਰ ਸਾਡੀ ਰਾਜ ਭਾਸ਼ਾ ਪੰਜਾਬੀ ਆ ਅਤੇ ਜਦੋਂ ਅਸੀਂ ਅਧਿਆਪਕਾਂ ਨਾਲ ਪੰਜਾਬੀ ਭਾਸ਼ਾ ਵਿੱਚ ਗੱਲਬਾਤ ਕਰਦੇ ਹਾਂ ਉਹਨਾਂ ਤੋਂ ਸਿੱਖਦੇ ਹਾਂ ਤਾਂ ਉਹ ਸਾਡੇ ਜਿਹੜਾ ਸਿੱਖਣ ਦੀ ਜਿਹੜੀ ਸਾਡੀ ਸ਼ਮਤਾ ਆ ਸਿੱਖਣ ਦੀ ਜਿਹੜੀ ਸਮਰੱਥਾ ਆ ਉਹ ਬਹੁਤ ਤੇਜ਼ ਹੋ ਜਾਂਦੀ ਹੈ ਕਿਉਂਕਿ ਜਿਵੇਂ ਅਸੀਂ ਜਾਣਦੇ ਹਾਂ ਕਿ ਸਿਆਣੇ ਕਹਿੰਦੇ ਆ ਕਿ ਹਰੇਕ ਆਦਮੀ ਜਿਹੜਾ ਵਾ ਉਹ ਆਪਣੀ ਮਾਤ ਭਾਸ਼ਾ ਵਿੱਚ ਆਪਣੀ ਰਾਜ ਭਾਸ਼ਾ ਵਿੱਚ ਬੜੇ ਅੱਛੇ ਤਰੀਕੇ ਨਾਲ ਸਿੱਖ ਸਕਦਾ ਕਿਉਂਕਿ ਉਹ ਜਿਹੜੀ ਉਹਦੀ ਸੋਚਣ ਦੀ ਸ਼ਕਤੀ ਹੁੰਦੀ ਆ ਉਹ ਰਾਜ ਭਾਸ਼ਾ ਮਾਤ ਭਾਸ਼ਾ ਵਿੱਚ ਮਾਤ ਭਾਸ਼ਾ ਵਿੱਚ ਜਿਹੜੀ ਬੋਲਣ ਦੀ ਸ਼ਕਤੀ ਜ਼ਿਆਦਾ ਹੁੰਦੀ ਆ ਬਾਕੀ ਭਾਸ਼ਾ ਦੇ ਮੁਕਾਬਲੇ ਸੋ ਮੇਰਾ ਯੇ ਇਹੀ ਕਹਿਣਾ ਆ ਕਿ ਜਿਹੜੀ ਪੰਜਾਬੀ ਭਾਸ਼ਾ ਆ ਉਹ ਸਾਡੇ ਰਾਜ ਵਿੱਚ ਸਿੱਖਿਆ ਪ੍ਰਣਾਲੀ ਵਿੱਚ ਬਹੁਤ ਅੱਛੀ ਭੂਮਿਕਾ ਨਿਭਾ ਰਹੀ ਹੈ ਜਿਹਦੇ ਯਤਨਾਂ ਸਦਕਾ ਜਿਹਦੇ ਯਤਨਾਂ ਸਦਕਾ ਜਿਹੜੀ ਸਾਡੇ ਪੰਜਾਬ ਦੇ ਨੌਜਵਾਨ ਆ ਉਹ ਆਪਣੇ ਆਪਣੇ ਹਿੱਸਿਆਂ ਵਿੱਚ ਕਾਮਯਾਬ ਹੋ ਰਹੇ ਨੇ ਧੰਨਵਾਦ